ਹੈਲੋ ਹਾਂਜੀ ਹਾਂਜੀ

ਕੀ ਨਾਂ ਹੈ ਤੁਹਾਡੇ ਬੱਚੇ ਦਾ ਹਰਪ੍ਰੀਤ ਹਾਂਜੀ ਉਹ ਮੁੰਡਾ ਵਧੀਆ ਕੰਮ ਕਰ ਰਿਹਾ ਬਹੁਤ ਵਧੀਆ ਹਰਮੋਨੀਅਮ ਤਾਂ ਉਹ ਕਾਫੀ ਅੱਛਾ ਹੁਣ ਵਜਾਉਣ ਲੱਗ ਗਿਆ ਔਰ ਉਹਨੂੰ ਉਹਨੂੰ ਰਾਗ ਸਿਖਾਏ ਸੀ ਦੋ ਔਰ ਦੋ ਤਾਲਾਂ ਦੋ ਤਾਲਾਂ ਸਿਖਾਈਆਂ ਸੀ ਅਤੇ ਪ੍ਰੈਕਟਿਸ ਮੇਰੇ ਕੋਲ ਤਾਂ ਬਹੁਤ ਵਧੀਆ ਕਰ ਰਿਹਾ ਲੇਕਿਨ ਤੁਹਾਡੇ ਕੋਲ ਘਰੇ ਹਰਮੋਨੀਅਮ ਹੈਗਾ ਅਤੇ ਥੋੜ੍ਹਾ ਜਿਹਾ ਨਾ ਤੁਸੀਂ ਉਹਨੂੰ ਨਹੀਂ ਪ੍ਰੈਕਟਿਸ ਹੈ ਤੁਸੀਂ ਜਿਹੜਾ ਕੁਛ ਮੈਂ ਇੱਥੇ ਕਰਾਉਣਾ ਤੁਸੀਂ ਘਰੇ ਉਹਨੂੰ ਚੈੱਕ ਕਰਿਆ ਕਰੋ ਕਿ ਘਰੇ ਵੀ ਉਹ ਚੀਜ਼ ਉਵੇਂ ਤੁਹਾਨੂੰ ਵਜਾ ਕੇ ਦਿਖਾ ਰਿਹਾ ਜਾਂ ਨਹੀਂ ਕਿਉਂਕਿ ਤੁਹਾਡੀ ਵੀ ਤਸੱਲੀ ਹੋ ਜਾਏਗੀ ਵੀ ਉਹ ਕਿੰਨਾ ਕੁ ਸਿੱਖ ਗਿਆ ਅਤੇ ਉਹਨੂੰ ਇਹ ਤਾਂ ਬਾਕੀ ਤੁਹਾਨੂੰ ਮੈਂ ਤਾਂ ਪੂਰਾ ਇਹਨੂੰ ਆਪਦੇ ਵੱਲੋਂ ਸਿਖਾ ਸਕਨਾ ਅੱਗੋਂ ਤਾਂ ਇਹਦੀ ਪ੍ਰੈਕਟਿਸ 'ਤੇ ਹੈਗਾ ਪਰ ਜਿੰਨੀ ਜ਼ਿਆਦਾ ਪ੍ਰੈਕਟਿਸ ਕਰੇਗਾ ਉਨਾ ਜ਼ਿਆਦਾ ਇਹਨੇ ਫਾਇਦਾ ਮਿਲਣਾ ਜੀ ਇਹ ਤਾਂ ਮਿਊਜਿਕ ਦੇ ਵਿੱਚ ਤਾਂ ਕੋਈ ਦਿਨ ਫਿਕਸ ਨਹੀਂ ਹੁੰਦੇ ਨਾ ਵੀ ਇੰਨੇ ਦਿਨਾਂ 'ਚ ਸਿੱਖਣਾ ਪਹਿਲਾਂ ਇਹਦੀ ਪ੍ਰੈਕਟਿਸ ਜੇ ਬਾਕੀ ਹੈਗੇ ਤਾਂ ਹਾਂ ਇਹਦਾ ਹੱਥ ਤਾਂ ਪੂਰਾ ਚੱਲਣ ਲੱਗ ਗਿਆ ਜੇ ਹੋਰ ਦੇਖੋ ਮਹੀਨਾ ਡੇਢ ਹੋਰ ਅਗਰ ਹਰਮੌਨੀਅਮ 'ਤੇ ਅੱਛਾ ਲਾਂਦਾ ਰਹੇਗਾ ਇਹ ਪੂਰਾ ਟ੍ਰੇਨਡ ਹੋ ਜਾਏਗਾ ਬਾਕੀ ਇਹ ਘਰੇ ਜਿੰਨਾ ਜ਼ਿਆਦਾ ਪ੍ਰੈਕਟਿਸ ਕਰਦਾ ਰਹੇਗਾ ਉੱਨਾਂ ਇਹਦਾ ਹੱਥ ਹੋਰ ਜਲਦੀ ਖੁੱਲ੍ਹ ਜਾਏਗਾ ਔਰ ਚੰਗੀ ਤਰ੍ਹਾਂ ਕਰਨ ਲੱਗ ਜੇਗਾ ਵਜਾਉਣ ਲੱਗ ਜੇਗਾ ਹਾਂ ਹਾਂਜੀ ਹਾਂਜੀ ਬਣ ਜੇਗਾ ਵਧੀਆ ਬਣ ਜੇਗਾ ਗਾਉਂਦਾ ਵੀ ਵਧੀਆ ਥੋੜ੍ਹਾ ਜਿਹਾ ਖਾਣ ਪੀਣ ਦੀਆਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਕਿਉਂਕਿ ਇਹਦੇ ਗਲੇ ਦਾ ਕੰਮ ਹੈ ਅਤੇ ਫਿਰ ਗਲੇ ਦੇ ਕੰਮ 'ਚ ਖਾਣ ਪੀਣ ਦੀਆਂ ਚੀਜ਼ਾਂ ਉਸ ਤਰ੍ਹਾਂ ਦੀਆਂ ਰੱਖੋ ਹਲਕਾ ਖਾਵੇ ਜ਼ਿਆਦਾ ਹੈਵੀ ਨਾ ਖਾਇਆ ਕਰੇ ਜੀ ਠੀਕ ਹੈ ਜੀ ਹਾਂ ਚਲੋ ਠੀਕ ਹੈ ਜੀ ਬਾਕੀ ਤੁਸੀਂ ਕਦੇ ਆ ਗਏ ਇੱਥੇ ਵੀ ਵੇਖ ਲਿਆ ਚੈੱਕ ਕਰ ਲਿਆ ਜੇ ਹਾਂਜੀ ਠੀਕ ਹੈ ਜੀ